ਜਦੋਂ ਪਿੰਡ ਵਿੱਚ ਕੋਈ ਵੀ ਇਨਸਾਨ ਮਰ ਜਾਂਦਾ ਹੈ ਤਾਂ ਉਸਦੇ ਕੋਲ ਪਹਿਲਾਂ ਦੀਵਾ ਬੱਤੀ ਜਗਾਈ ਜਾਂਦੀ ਹੈ ਅਤੇ ਉਸਦੇ ਕੋਲ ਕਣਕ ਰੱਖੀ ਜਾਂਦੀ ਹੈ ਤਾਂ ਕਿ ਉਸਨੂੰ ਅੱਗੇ ਵੀ ਚਾਨਣ ਹੋ ਸਕੇ ਅਤੇ ਫਿਰ ਉਸ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਸਦੇ ਚਿਹਰੇ ਨੂੰ ਚਾਦਰ ਦੇ ਨਾਲ ਢੱਕ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਉਸ ਦੇ ਅੰਤਿਮ ਸੰਸਕਾਰ ਦੀਆਂ ਵਿਧੀਆਂ ਕੀਤੀਆਂ ਜਾਂਦੀਆਂ ਹਨ ਅਤੇ ਅੰਤਿਮ ਸੰਸਕਾਰ ਦੇ ਵਿੱਚ ਪਹਿਲਾਂ ਉਹਨੂੰ ਨਵਾਇਆ ਜਾਂਦਾ ਹੈ ਨਵਾ ਕੇ ਫਿਰ ਉਹਨਾਂ ਦੇ ਕੱਪੜੇ ਪੁਆਏ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਲਿਟਾਇਆ ਜਾਂਦਾ ਹੈ ਅਤੇ ਜਿੱਥੇ ਕਿ ਘਰ ਦੀਆਂ ਨੂੰਹਾਂ ਧੀਆਂ ਮੱਥਾ ਟੇਕਦੀਆਂ ਹਨ ਅਤੇ ਉਹਨੂੰ ਅੰਤਿਮ ਵਿਦਾਈ ਦਿੰਦੀਆਂ ਹਨ ਇਸ ਸਮੇਂ 'ਤੇ ਨੂੰਹਾਂ ਨੂੰ ਚਿੱਟੀ ਚੁੰਨੀ ਦੇ ਦਿੱਤੀ ਜਾਂਦੀ ਹੈ ਅਤੇ ਜੇ ਮੌਤ ਕਿਸੇ ਬਜ਼ੁਰਗ ਦੀ ਹੋਈ ਹੋਵੇ ਤਾਂ ਚੁੰਨੀਆਂ 'ਤੇ ਹਲਦੀ ਜਾ ਕੇਸਰ ਲਗਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਉਹ ਗਰੀ ਦੀ ਠੂਠੀ ਦੇ ਨਾਲ ਮੱਥਾ ਟੇਕਦੀਆਂ ਹਨ ਅਤੇ ਜੇ ਕੋਈ ਬਜ਼ੁਰਗ ਪੋਤਰੇ ਦੋਤਰੇ ਪੜਪੋਤਰਿਆਂ ਵਾਲਾ ਹੋਵੇ ਤਾਂ ਉਸ ਨੂੰ ਸੋਨੇ ਦੀ ਪੋੜੀ ਵੀ ਚੜ੍ਹਾਇਆ ਜਾਂਦਾ ਹੈ ਅਤੇ ਫਿਰ ਉਸਨੂੰ ਅੰਤਿਮ ਵਿਦਾਈ ਦਿੱਤੀ ਜਾਂਦੀ ਹੈ